ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਵੀਰੇ ਵਧੀਆ ਤੁਸੀਂ ਸੁਣਾਉ ਕਿੱਦਾਂ ਸਭ ਵਧੀਆ ਵੀਰੇ ਵਧੀਆ ਹਾਂ ਹਾਂ ਵੀਰੇ ਪੂਰਾ ਆਪਣੀ ਮੋਟਰ 'ਤੇ ਪੂਰੀ ਸ਼ੂਟਿੰਗ ਕਰਕੇ ਲੈ ਕੇ ਗਿਆ ਗਾਣਾ ਹੋਇਆ ਪੰਜਾਬੀ ਨਾ ਵੀਰੇ ਮੈ ਚਾਹੁੰਦਾ ਵੀ ਨਾ ਜਿਹੜਾ ਆਪਣਾ ਪੰਜਾਬ ਦਾ ਕਲਚਰ ਹੈ ਵੀਰੇ ਉਹ ਥੋੜ੍ਹਾ ਪਰੋਮੋਟ ਹੋਵੇ ਵਧੀਆ ਗੱਲ ਹੈ ਯਾਰ ਬੋਲੀਵੁੱਡ ਵਾਲੇ ਪੰਜਾਬ 'ਚ ਆ ਕੇ ਸ਼ੂਟਿੰਗਾਂ ਕਰ ਰਹੇ ਹੈ ਆਪਾਂ ਦੀ ਤਾਂ ਵਧੀਆ ਹਾਂ ਵੀਰੇ ਉਹ ਹੀ ਮੈਂ ਸੋਚ ਰਿਹਾ ਜਿਹੜੀ ਆਪਣੇ ਜਗ੍ਹਾ ਬਚੀ ਹੋਈ ਹੈ ਆਪਾਂ ਉੱਥੇ ਨਾ ਵਧੀਆ ਵਧੀਆ ਆਪਾਂ ਨੇ ਪੰਜਾਬੀ ਦੇ ਸੈੱਟ ਬਣਾਉਣੇ ਹੈ ਜਿੱਥੇ ਕੋਈ ਵੀ ਆਪਾਂ ਕਿਸੇ ਵੀ ਸ਼ੂਟਿੰਗ ਵਾਲੇ ਨੇ ਸ਼ੂਟ ਕਰਨਾ ਹੋਵੇ ਉਹਨੂੰ ਲੋਕੇਸ਼ਨ ਚਾਹੀਦੀ ਹੋਵੇ ਪੇਂਡੂ ਲੋਕੇਸ਼ਨ ਐਂਨ ਠੇਠ ਉਹ ਆਪਾਂ ਆਪਣੇ ਸੈੱਟ ਬਣਾ ਦੇਣੇ ਆਪਣੇ ਖੇਤਾਂ 'ਚ ਉੱਥੇ ਜਿਵੇਂ ਵੀ ਸ਼ੂਟਿੰਗ ਵਾਲੇ ਆਇਆ ਕਰੂਗੇ ਉਹਨਾਂ ਨੂੰ ਆਪਾਂ ਨੇ ਕਿਰਾਏ 'ਤੇ ਦਿਆ ਕਰਨੀਆਂ ਉਹਦਾ ਆਪਾਂ ਰੈਂਟ ਲਿਆ ਕਰਨਾ ਵਧੀਆ ਉਹ ਚੀਜ਼ਾਂ ਆਪਾਂ ਕਰਨੀਆਂ ਹੈ ਉਹਨੂੰ ਆਪਾਂ ਨੇ ਆਪਾਂ ਨੇ ਬਿਜ਼ਨੈਸ ਬਣਾ ਦੇਣਾ ਇੱਕ ਵਧੀਆ ਤਰੀਕੇ ਦਾ ਉਹ ਵੀਰੇ ਉਹ ਤਾਂ ਹੁੰਦਾ ਰਹਿੰਦਾ ਹੁਣ ਚੱਲਦਾ ਰਹਿੰਦਾ ਵੀਰੇ ਆਪਾਂ ਨੇ ਪੂਰਾ ਐਂਨ ਪੂਰਾ ਸੈੱਟ ਹੀ ਬਣਾ ਦੇਣਾ ਐਂਨ ਪੰਜਾਬੀ ਠੇਠ ਸੈੱਟ ਬਣਾ ਦੇਣਾ ਪੂਰਾ ਐਨ ਵੱਖ ਵੱਖ ਚੀਜ਼ਾਂ ਰੱਖ ਦੇਣੀਆਂ ਚਲ ਚੰਗਾ ਓਕੇ ਚੰਗਾ ਵੀਰੇ ਓਕੇ ਜੀ